ਮੈਂ ਫਲਿੱਪਕਾਰਡ ਤੋਂ ਪਹਿਲੀ ਵਾਰ ਇੱਕ ਕੁੜਤੀ ਮੰਗਵਾਈ ਸੀ ਉਹ ਕੁੜਤੀ ਮੈਨੂੰ ਬਹੁਤ ਹੀ ਪਸੰਦ ਆਈ ਜਦੋਂ ਉਹ ਡਿਲੀਵਰੀ ਵਾਲਾ ਮੇਰੇ ਘਰ ਮੈਨੂੰ ਕੁੜਤੀ ਦੇ ਕੇ ਗਿਆ ਤਾਂ ਉਹ ਕੁੜਤੀ ਬਿਲਕੁਲ ਉੱਦਾਂ ਦੀ ਸੀ ਜਿੱਦਾਂ ਦੀ ਮੈਂ ਇੰਟਰਨੈੱਟ 'ਤੇ ਫੋ ਵੇਖੀ ਸੀ ਕੁੜਤੀ ਵਿੱਚ ਕੋਈ ਵੀ ਡਿਫੈਕਟ ਨਹੀਂ ਸੀ ਕੁੜਤੀ ਬਹੁਤ ਵਧੀਆ ਸੀ ਉਹਦਾ ਕਲਰ ਵੀ ਉਹ ਹੀ ਸੀ ਜਿਹੜਾ ਇਮੇਜ ਵਿੱਚ ਵਿਖਾਇਆ ਗਿਆ ਸੀ ਬਿਲਕੁਲ ਸੇਮ ਟੂ ਸੇਮ ਸੀ ਐਂਡ ਮੈਨੂੰ ਉਹ ਕੁੜਤੀ ਬਹੁਤ ਜ਼ਿਆਦਾ ਪਸੰਦ ਆਈ